ਮੈਂ ਆਪਣੇ ਦੋਸਤ ਦੇ ਕਹਿਣ 'ਤੇ ਬੀ ਐੱਸ ਕੇ ਕੰਪਨੀ ਦਾ ਕੂਲਰ ਖਰੀਦਿਆ ਇਸ ਦੀ ਪਲਾਸਟਿਕ ਬਹੁਤ ਹੀ ਘਟੀਆ ਸੀ ਚਲਾਉਣ ਸਮੇਂ ਇਸਦੀ ਆਵਾਜ਼ ਵੀ ਵੱਧ ਆਉਂਦੀ ਸੀ ਅਤੇ ਇਸਦੀ ਬਿਜਲੀ ਖੱਪਤ ਵੀ ਬਹੁਤ ਜ਼ਿਆਦਾ ਸੀ